ਮੈਂ ਵਿਜੇ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਸਭ ਤੋਂ ਵਧੀਆ ਸ਼ੌਂਕ ਇਹ ਰੱਖਦਾ ਹਾਂ ਕਿ ਮੈਨੂੰ ਲਿਖਣ ਦਾ ਪੜ੍ਹਨ ਦਾ ਸ਼ੌਂਕ ਹੈ ਮੈਂ ਪੰਜਾਬੀ ਭਾਸ਼ਾ ਵਿੱਚ ਲਿਖਦਾ ਹਾਂ ਅਤੇ ਪੰਜਾਬੀ ਭਾਸ਼ਾ ਨੂੰ ਵਧੀਆ ਤਰੀਕੇ ਨਾਲ ਪੜ੍ਹਦਾ ਹਾਂ ਕਿਉਂਕਿ ਆਮ ਇਹ ਧਾਰਨਾ ਹੈ ਕਿ ਲਿਖਣ ਪੜ੍ਹਨ ਵੇਲੇ ਸਾਨੂੰ ਇਕਾਂਤ ਜਗ੍ਹਾ ਵਿੱਚ ਬੈਠ ਕੇ ਲਿਖਣਾ ਜਾਂ ਪੜ੍ਹਨਾ ਚਾਹੀਦਾ ਹੈ ਜੇਕਰ ਅਸੀਂ ਇਕਾਂਤ ਸ਼ਾਂਤ ਵਾਤਾਵਰਨ ਵਿੱਚ ਲਿਖਣ ਦੀ ਦੋਹਰਾਈ ਕਰਾਂਗੇ ਤਾਂ ਉੱਥੇ ਹੀ ਸਾਡੇ ਕੋਲੋਂ ਵਧੀਆ ਤਰ੍ਹਾਂ ਨਾਲ ਲਿਖਿਆ ਜਾ ਸਕਦਾ ਹੈ ਕੁਝ ਲੋਕ ਕਵਿਤਾ ਲਿਖਦੇ ਹਨ ਕੁਝ ਕਹਾਣੀ ਲਿਖਦੇ ਹਨ ਕੁਝ ਨਾਟਕ ਲਿਖਦੇ ਹਨ ਕੁਝ ਨਾਵਲ ਲਿਖਦੇ ਹਨ ਅਤੇ ਕੁਝ ਆਪਣੀ ਆਪਣੀ ਸਮਝ ਦੇ ਅਧਾਰ 'ਤੇ ਆਪਣੇ ਆਪਣੇ ਆਨੰਦ ਦੇ ਅਧਾਰ 'ਤੇ ਲਿਖਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ ਪਰ ਮੈਂ ਜ਼ਿਆਦਾ ਕਵਿਤਾ ਲਿਖਦਾ ਹਾਂ ਤੇ ਕਵਿਤਾ ਨੂੰ ਪੜ੍ਹਨ ਦਾ ਸ਼ੌਂਕ ਰੱਖਦਾ ਹਾਂ ਮੈਨੂੰ ਸ਼ੇਅਰੋ ਸ਼ਾਇਰੀ ਕਰਨ ਦਾ ਬੜਾ ਹੀ ਵਧੀਆ ਤਰੀਕਾ ਲੱਗਦਾ ਹੈ ਕਿਉਂਕਿ ਮੈਂ ਲਿਖੇ ਹੋਏ ਸ਼ੇਅਰਾਂ ਨੂੰ ਵਧੀਆ ਤਰੀਕੇ ਨਾਲ ਪੜ੍ਹ ਸਕਦਾ ਹਾਂ ਅਤੇ ਸਟੇਜ ਉੱਤੇ ਉਹਨਾਂ ਨੂੰ ਬੋਲ ਵੀ ਸਕਦਾ ਹਾਂ ਇਸ ਲਈ ਸਭ ਤੋਂ ਆਰਾਮਦਾਇਕ ਜਗ੍ਹਾ ਕਹੀ ਜਾ ਸਕਦੀ ਹੈ ਕਿ ਤੁਸੀਂ ਛੱਤ 'ਤੇ ਇਕਾਂਤ ਵਿੱਚ ਬੈਠ ਕੇ ਲਿਖ ਸਕਦੇ ਹੋ ਜਾਂ ਨਹਿਰ ਦੇ ਕਿਨਾਰੇ ਜਾ ਕੇ ਲਿਖ ਸਕਦੇ ਹੋ ਜਾਂ ਕਿਸੇ ਪੇੜ ਦੇ ਹੇਠਾਂ ਬੈਠ ਕੇ ਆਰਾਮ ਨਾਲ ਆਪਣੇ ਬਿਲਕੁਲ ਅੰਤਰ ਧਿਆਨ ਹੋ ਕੇ ਵਧੀਆ ਲਿਖਣ ਕਲਾ ਕੀਤੀ ਜਾ ਸਕਦੀ ਹੈ ਅਤੇ ਇਹ ਹੀ ਮੈਨੂੰ ਪਸੰਦ ਹੈ ਧੰਨਵਾਦ